ਅੱਜ ਕੱਲ੍ਹ ਗੁਰਦੁਆਰਿਆਂ ਵਿੱਚ ਜਿਹੜਾ ਕਿ ਬਹੁਤ ਜ਼ਿਆਦਾ ਬਦਲਾਵ ਕੀਤਾ ਗਿਆ ਹੈ ਜਿੱਦਾਂ ਕਿ ਅੱਜ ਕੱਲ੍ਹ ਹੁਕਮਨਾਮੇ ਪਹਿਲਾਂ ਲਿਖਣੇ ਪੈਂਦੇ ਹੁੰਦੇ ਸੀਗੇ ਅੱਜ ਕੱਲ੍ਹ ਡਿਜੀਕਲ ਕਲ ਕੰਮ ਹੋ ਗਿਆ ਅਤੇ ਉਹਦੀ ਫੋਟੋ ਖਿੱਚ ਕੇ ਅਤੇ ਬਾਹਰ ਜਿਹੜਾ ਕਿ ਡਿਜੀਟਲ ਤਰੀਕੇ ਨਾਲ ਉਹਨੂੰ ਦਿਖਾਇਆ ਜਾਂਦਾ ਹੈ ਅਤੇ ਅੱਜ ਕੱਲ੍ਹ ਸੰਗਤਾਂ ਲਈ ਪਿੱਛੇ ਜਿਹੜੀਆਂ ਸੰਗਤਾਂ ਬਹਿੰਦੀਆਂ ਨੇ ਉਹਨਾਂ ਲਈ ਅੱਗੇ ਮਤਲਬ ਅੱਗੇ ਨਜ਼ਰ ਉਹਨਾਂ ਦੀ ਨਹੀ ਮਤਲਬ ਮਿਲਦੀ ਹੈਗੀ ਤਾਂ ਉਹਨਾਂ ਲਈ ਐੱਲ ਸੀ ਡੀ ਵਗੈਰਾ ਦਾ ਵੀ ਉਪਲਬਧ ਕੀਤੀ ਜਾਂਦੀ ਹੈ